ਅੱਜ ਕੱਲ੍ਹ ਵਿਗਿਆਨ ਤੱਕ ਪਹੁੰਚਣ ਦੇ ਬਹੁਤ ਸਾਰੇ ਤਰੀਕੇ ਬਣ ਗਏ ਹਨ ਜਿਵੇਂ ਕਿ ਇੰਟਰਨੈੱਟ 'ਤੇ ਹਰੇਕ ਨਿਊਜ਼ਪੇਪਰ ਉਪਲਬਧ ਰਿਹਾ ਹੈ ਜਿਸ ਕਰਕੇ ਸਾਨੂੰ ਹਰ ਬਾਰੇ ਜਾਣਕਾਰੀ ਮਿਲਦੀ ਰਹੀ ਹੈ ਤਾਂ ਇਸ ਕਰਕੇ ਵਿਗਿਆਨ ਤੱਕ ਪਹੁੰਚਣਾ ਬਹੁਤ ਹੀ ਆਸਾਨ ਹੋ ਗਿਆ ਹੈ